ਅੰਮ੍ਰਿਤਸਰ ਜ਼ਿਲ੍ਹੇ ਵਿੱਚ ਬਹੁਤ ਸਾਰੇ ਤਿਉਹਾਰ ਮਨਾਏ ਜਾਂਦੇ ਹਨ ਜਿਵੇਂ ਕਿ ਦਿਵਾਲੀ ਦੁਸਹਿਰਾ ਬਸੰਤ ਰੱਖੜੀ ਲੋਹੜੀ ਗੁਰੂਆਂ ਦੇ ਗੁਰਪੁਰਬ ਆਦਿ ਆਦਿ ਇਹ ਤਿਉਹਾਰ ਅੰਮ੍ਰਿਤਸਰ ਜ਼ਿਲ੍ਹੇ ਵਿਚ ਬਹੁਤ ਹੀ ਧੂਮ ਧਾਮ ਨਾਲ ਮਨਾਏ ਜਾਂਦੇ ਹਨ ਇਹਨਾਂ ਦਾ ਧਾ ਬਹੁਤ ਸਾਰਾ ਮਹੱਤਵ ਹੈ ਸਾਡੇ ਵੱਡੇ ਵਡੇਰੇ ਜਿਵੇਂ ਦਿਵਾਲੀ ਦੁਸਹਿਰਾ ਮਨਾਉਂਦੇ ਆਏ ਜਦ ਅਸੀਂ ਵੀ ਉਹਨਾਂ ਨੂੰ ਮਨਾਉਂਦੇ ਹਾਂ ਤਾਂ ਸਾਡੇ ਬੱਚਿਆਂ ਤੱਕ ਵੀ ਉਹ ਤਿਉਹਾਰਾਂ ਨੂੰ ਮਨਾਉਣ ਦਾ ਉਤਸ਼ਾਹ ਪੈਦਾ ਹੁੰਦਾ ਹੈ ਇਸ ਕਰਕੇ ਇਹਨਾਂ ਤਿਉਹਾਰਾਂ ਨੂੰ ਇਸੇ ਤਰ੍ਹਾਂ ਹੀ ਮਨਾਉਂਦੇ ਰਹਿਣਾ ਚਾਹੀਦਾ ਹੈ ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਉਸੇ ਤਰ੍ਹਾਂ ਉਹਨਾਂ ਤਿਉਹਾਰਾਂ ਨੂੰ ਮਨਾਉਂਦੀਆਂ ਰਹਿਣ ਔਰ ਉਹਨਾਂ ਦੇ ਨਾਲ ਰੂਬਰੂ ਹੁੰਦੀਆਂ ਰਹਿਣ ਔਰ ਅੰਮ੍ਰਿਤਸਰ ਵਿੱਚ ਹੋਰ ਵੀ ਕਈ ਤਰ੍ਹਾਂ ਦੇ ਮੇਲੇ ਲੱਗਦੇ ਆ ਜਿਵੇਂ ਕਿ ਨਿਊ ਅੰਮ੍ਰਿਤਸਰ ਵਿੱਚ ਪੀਟੈਕਸ ਮੇਲਾ ਲੱਗਦਾ ਉੱਥੇ ਲੋਕ ਬਾਹਰੋਂ ਆਪਣਾ ਸਾਮਾਨ ਲਿਆ ਕੇ ਆਪਣਾ ਵਪਾਰ ਵਧਾਉਂਦੇ ਆ ਔਰ ਲੋਕੀ ਖਰੀਦੋ ਫ਼ਰੋਖ਼ਤ ਵੀ ਕਰਦੇ ਹਨ ਅਸੀਂ ਇਹਨਾਂ ਤਿਉਹਾਰਾਂ ਨੂੰ ਵੀ ਬੜੀ ਬੜੀ ਹੀ ਧੂਮ ਧਾਮ ਨਾਲ ਮਨਾਉਂਦੇ ਹਾਂ ਬੜੇ ਉਤਸ਼ਾਹ ਨਾਲ ਮਨਾਉਂਦੇ ਹਾਂ ਅਤੇ ਜਿਵੇਂ ਕਿ ਗੁਰੂਆਂ ਦੇ ਗੁਰਪੁਰਬ ਹਨ ਉਹਨਾਂ ਨੂੰ ਤਾਂ ਅਸੀਂ ਬੜੇ ਹੀ ਸਤਿਕਾਰ ਨਾਲ ਮਨਾਉਂਦੇ ਹਾਂ ਗੁਰ ਜਦ ਗੁਰੂਆਂ ਦੇ ਜਨਮ ਦਿਨ ਆਉਂਦੇ ਹਨ ਤਾਂ ਇੱਕ ਦਿਨ ਪਹਿਲੇ ਗੁਰਪੁਰਬ ਨਗਰ ਕੀਰਤਨ ਕੱਢਿਆ ਜਾਂਦਾ ਆ ਥਾਂ ਥਾਂ 'ਤੇ ਲੰਗਰ ਲੱਗਦੇ ਹਨ ਵੰਨ ਸੁਵੰਨੇ ਭੋਜਨ ਲੋਕਾਂ ਨੂੰ ਛਕਾਏ ਜਾਂਦੇ ਹਨ ਇਸ ਤਰ੍ਹਾਂ ਜਦ ਜਨਮ ਦਿਨ ਹੁੰਦਾ ਹੈ ਤਾਂ ਉੱਥੇ ਵੱਖ ਵੱਖ ਕਵੀ ਕੀਰਤਨੀਏ ਵੀ ਆਉਂਦੇ ਹਨ ਜੋ ਕਿ ਬਹੁਤ ਸੋਹਣਾ ਕੀਰਤਨ ਕਰਦੇ ਆ ਅਸੀਂ ਬੜੀ ਹੀ ਸ਼ਰਧਾ ਨਾਲ ਉਹਨਾਂ ਨੂੰ ਸੁਣਦੇ ਹਾਂ ਥਾਂ ਥਾਂ 'ਤੇ ਲੰਗਰ ਲੱਗੇ ਹੁੰਦੇ ਹਨ ਲੰਗਰ ਵੀ ਛਕਦੇ ਹਾਂ ਅਤੇ ਉਹਨਾਂ ਲੋਕਾਂ ਦੀਆਂ ਤਕਰੀਰਾਂ ਨੂੰ ਵੀ ਸੁਣਦੇ ਹਾਂ ਅਸੀਂ ਇਸ ਤਰ੍ਹਾਂ ਮਨਾਉਂਦੇ ਹਾਂ ਕਿ ਜਦ ਕੋਈ ਤਿਉਹਾਰ ਆਉਂਦਾ ਹੈ ਜਿਵੇਂ ਕਿ ਦੁਸਹਿਰਾ ਦਿਵਾਲੀ ਜਾਂ ਕੋਈ ਹੋਰ ਤਿਉਹਾਰ ਹੁੰਦਾ ਹੈ ਅਤੇ ਅਸੀਂ ਆਪਣੀ ਮੁਹੱਲੇ ਵਿੱਚ ਸਾਰੇ ਲੋਕ ਇਕੱਠੇ ਹੋ ਕੇ ਉਸ ਤਿਉਹਾਰ ਨੂੰ ਸ਼ਾਮ ਦੇ ਵੇਲੇ ਮਨਾਉਂਦੇ ਹਾਂ ਟੈਂਟ ਕਨਾਤਾਂ ਲਗਾ ਲੈਂਦੇ ਹਾਂ ਵਧੀਆ ਵਧੀਆ ਭੋਜਨ ਤਿਆਰ ਕੀਤੇ ਜਾਂਦੇ ਹਨ ਅਸੀਂ ਸਾਰੇ ਰਲ਼ ਮਿਲ ਕੇ ਲੰਗਰ ਛਕਦੇ ਹਾਂ ਅਤੇ ਬੈਠ ਕੇ ਗੱਲਾਂ ਬਾਤਾਂ ਵੀ ਕਰ ਲੈਂਦੇ ਹਾਂ ਆਪਣੇ ਸਨੇਹੀਆਂ ਨੂੰ ਵੀ ਮਿਲ ਲੈਂਦੇ ਹਾਂ ਇਸ ਤਰ੍ਹਾਂ ਸਾਨੂੰ ਇਹਨਾਂ ਤਿਉਹਾਰਾਂ ਨੂੰ ਮਨਾਉਣ ਵਿੱਚ ਬਹੁਤ ਹੀ ਨਜ਼ਾਰਾ ਆਉਂਦਾ ਹੈ ਬਹੁਤ ਮਜ਼ਾ ਆਉਂਦਾ ਹੈ ਧੰਨਵਾਦ ਜੀ